ਵੈਸੇ ਮੈਂ ਨਿਊਜ਼ ਵੱਲੋਂ ਕੋਈ ਇੰਨੀ ਖਾਸ ਜਾਣਕਾਰੀ ਨਹੀਂ ਰੱਖਦੀ ਪਰ ਹਾਂ ਕਈ ਵਾਰੀ ਨਿਊਜ਼ ਸੁਣਨ ਬੈਠ ਜਾਓ ਤਾਂ ਪਤਾ ਲੱਗਦਾ ਹੈ ਕਿ ਨਿਊਜ਼ ਵਿੱਚ ਵੀ ਫੇਕ ਖਬਰਾਂ ਜ਼ਿਆਦਾ ਫੈਲਦੀਆਂ ਲੋਕ ਮਲ ਕਿ ਉਹ ਖਬਰ ਹੁੰਦੀ ਨਹੀਂ ਹੈ ਜਿਹੜੀ ਨਿਊਜ਼ ਵਿੱਚ ਦੱਸੀ ਜਾਂਦੀ ਹੈ ਹੁਣ ਇੱਕ ਐਕਟਰ ਸੀ ਫਿਲਮ ਐਕਟਰ ਪੂਨਮ ਪਾਂਡੇ ਹੈਂ ਇੱਕ ਦਿਨ ਦ ਨਿਊਜ਼ ਵਿੱਚ ਦੱਸਿਆ ਗਿਆ ਕਿ ਉਹਨਾਂ ਦੀ ਡੈਥ ਹੋ ਗਈ ਹੈ ਓਰ ਇਹ ਕਲੇਮ ਕੀਤਾ ਗਿਆ ਕਿ ਉਹ ਦੁਨੀਆ ਵਿੱਚ ਨਹੀਂ ਰਹੇ ਦੂਸਰੇ ਹੀ ਦਿਨ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਉਹ ਜਿੰਦਾ ਹੋ ਗਏ ਆ ਅਤੇ ਇਹੋ ਜਿਹੀਆਂ ਗਲਤ ਖਬਰਾਂ ਦੱਸ ਕੇ ਅਤੇ ਸਾਡੇ ਇੱਥੋਂ ਦਾ ਮਾਹੌਲ ਖਰਾਬ ਕੀਤਾ ਜਾਵੇ ਕਰਦਾ ਫੇਕ ਨਿਊਜ਼ ਦਿੱਤੀ ਜਾਂਦੀ ਹੈ ਫੇਕ ਖਬਰਾਂ ਦੱਸੀਆਂ ਜਾਂਦੀਆਂ ਜਿੱਥੋਂ ਪਤਾ ਨਹੀਂ ਲੱਗਦਾ ਕਿ ਮੀਡੀਆ 'ਤੇ ਵੀ ਵਿਸ਼ਵਾਸ ਕੀਤਾ ਜਾਵੇ ਕਿ ਨਹੀਂ ਕੀਤਾ ਜਾਵੇ ਹਮੇਸ਼ਾ ਕੋਈ ਖਾਸ ਇੰਨੀ ਜਾਣਕਾਰੀ ਤਾਂ ਰੱਖਦੇ ਨਹੀਂ ਪਰ ਕਦੀ ਕਦੀ ਸੁਣੋ ਤਾਂ ਬੜਾ ਦੁੱਖ ਹੁੰਦਾ ਕਿ ਕੀ ਹੋਏ ਕਰਦਾ ਹੈ ਕਿ ਫੇਕ ਖਬਰਾਂ ਵੀ ਕਿਸ ਤਰ੍ਹਾਂ ਫੈਲਦੀਆਂ ਹੈ